ਅਸੀਂ ਵੇਖਦੇ ਹਾਂ ਕਿ ਸਾਡੇ ਜੀਵਨ 'ਚ ਪੰਜਾਬੀ ਭਾਸ਼ਾ ਦਾ ਬਹੁਤ ਮਹੱਤਵ ਹੈ ਕਿਉਂਕਿ ਪੰਜਾਬੀ ਭਾਸ਼ਾ ਤਾਂ ਸਾਡੀ ਮਾਂ ਬੈਲੀ ਬੋਲੀ ਭਾਸ਼ਾ ਹੈ ਜਦੋਂ ਦਾ ਅਸੀਂ ਮਤਲਬ ਜਦੋਂ ਦੇ ਮਤਲਬ ਜੰਮ ਜਨਮ ਹੋਇਆ ਸਾਡਾ ਉਦੋਂ ਦੀ ਸਾ ਘਰ ਵਿੱਚ ਪਹਿਲਾਂ ਆਪਾਂ ਜਦੋਂ ਬੱਚਾ ਸਿੱਖਦਾ ਕੁਛ ਅਤੇ ਉਹ ਪੰਜਾਬੀ ਹੀ ਸਿੱਖਦਾ ਹੈਗਾ ਹੈ ਅਤੇ ਇਸ ਵਾਸਤੇ ਫਿਰ ਪੰਜਾਬੀ ਭਾਸ਼ਾ ਸਾਨੂੰ ਬਹੁਤ ਪਸੰਦ ਹੈਗੀ ਹੈ ਪਰ ਅੱਜ ਕੱਲ੍ਹ ਵੀ ਥੋੜ੍ਹਾ ਪੰਜਾਬੀ ਦਾ ਨਾ ਦਿਨੋ ਦਿਨ ਉਹ ਥੋੜ੍ਹਾ ਖਤਮ ਹੋ ਹੋ ਰਿਹਾ ਹੈ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਅੱਜ ਕੱਲ੍ਹ ਲੋਕ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪਾਉਂਦੇ ਆ ਅਤੇ ਉੱਥੇ ਕਹਿੰਦੇ ਆ ਕਿ ਪੰਜਾਬੀ ਨਹੀਂ ਬੋਲਣੀ ਬੱਚਿਆਂ ਨੇ ਬੈਨ ਲਗਾ ਦਿੰਦੇ ਹੈ ਪਰ ਇਹ ਗਲਤ ਹੈ ਉਹਦੇ ਕਰਕੇ ਬੱਚੇ ਨਾ ਤਾਂ ਪੂਰੀ ਪੰਜਾਬੀ ਬੋਲਣਾ ਆਉਂਦੀ ਆ ਬੱਚਿਆਂ ਨੂੰ ਨਾ ਇੰਗਲਿਸ਼ 'ਚ ਢੰਗ ਨਾਲ ਬੋਲਣੀ ਆਉਂਦੀ ਹੈ ਨਾ ਹਿੰਦੀ ਉਹਨਾਂ ਨੂੰ ਢੰਗ ਨਾਲ ਕੁਛ ਵੀ ਜਿਵੇਂ ਬੱਚੇ ਮਿਕਸ ਸਾਰਾ ਕੁਛ ਕਰਨ ਲੱਗ ਜਾਂਦੇ ਹੈਗੇ ਹੈ ਪਰ ਉਹਨਾਂ ਨੂੰ ਪੰਜਾਬੀ ਵੀ ਬੁਲਵਾਉਣੀ ਚਾਹੀਦੀ ਹੈ ਕਿਉਂਕਿ ਆਪਣੀ ਨਾ ਪੰਜਾਬ ਵਾਲਿਆਂ ਦੀ ਤਾਂ ਇਹ ਮਾਂ ਬੋਲੀ ਭਾਸ਼ਾ ਹੈ ਐਨ ਜਦੋਂ ਇਹਨਾਂ ਦੇ ਪੰਨ ਮਾਂ ਬੋਲੀ ਭਾਸ਼ਾ ਹੈ ਇਹ ਪੰਜਾਬ ਵਾਲਿਆਂ ਦੀ ਅਤੇ ਜੇ ਬੱਚੇ ਨੂੰ ਪੰਜਾਬੀ ਨਾ ਆਵੇਗੀ ਤਾਂ ਫਿਰ ਪਤਾ ਕਿਵੇਂ ਲੱਗੇਗਾ ਕਿ ਉਹ ਪੰਜਾਬ ਦਾ ਹੈਗਾ ਹੈ ਪੰਜਾ ਪੰਜਾ ਪੰਜਾਬੀ ਤਾਂ ਦੇਸ਼ ਪੰਜਾਬ ਵਿੱਚ ਜ਼ਰੂਰੀ ਹੈ ਬਹੁਤ ਜ ਬੱਚੇ ਨੂੰ ਪਤਾ ਕਿਵੇਂ ਲੱਗੇਗਾ ਪੰਜਾਬ ਦਾ ਉਹ ਰੀਤੀ ਰਿਵਾਜ਼ ਵੀ ਸਾਰੇ ਜਿਵੇਂ ਆਪਣੇ ਜਿਹੜੇ ਪੰਜਾਬ ਦੇ ਹੈਗੇ ਆ ਉਹ ਵਧੀਆ ਹੈਗੇ ਆ ਬਹੁਤ ਜੀ